ਅੱਜ ਪੰਜਾਬ ਦੇ ਚੰਡੀਗੜ੍ਹ ਨੂੰ ਮਿਲਾ ਕੇ ਬਾਈ ਜ਼ਿ ਜ਼ਿਲ੍ਹੇ ਹੈ ਜਿਨ੍ਹਾਂ 'ਚੋਂ ਬਹੁਤ ਸੁੰਦਰ ਹੈ ਚੰਡੀਗੜ੍ਹ ਸ਼ਹਿਰ ਪਟਿਆਲਾ ਸ਼ਹਿਰ ਔਰ ਕੁਝ ਐਸੇ ਸ਼ਹਿਰ ਵੀ ਆ ਜਿਹੜੇ ਭੀੜ ਭੜੱਕੇ ਵਾਲੇ ਨੇ ਐਸੇ ਜ਼ਿਲ੍ਹੇ ਨੇ ਜਿਹੜੇ ਭੀੜ ਭੜੱਕੇ ਨੇ ਜਿਵੇਂ ਲੁਧਿਆਣਾ ਜ਼ਿਲ੍ਹਾ ਹੋ ਗਿਆ ਅੰਬਰਸਰ ਜ਼ਿਲ੍ਹਾ ਹੋ ਗਿਆ ਮਾਨਸਾ ਸ਼ਹਿਰ ਹੋ ਗਿਆ ਭੀੜ ਭੜੱਕੇ ਵਾਲੇ ਇਲਾਕੇ ਦਾ ਫ਼ਾਇਦਾ ਇਹ ਹੈ ਵੀ ਇੱਕ ਤਾਂ ਰੌਣਕ ਦੇਖਣ ਨੂੰ ਮਿਲਦੀ ਹੈ ਜਿੱਥੇ ਭੀੜ ਭੜੱਕਾ ਹੋਵੇ ਉੱਥੇ ਰੌਣਕ ਹੋਵੇਗੀ ਹਰ ਚੀਜ਼ ਆਪਾਂ ਨੂੰ ਮੌਕੇ 'ਤੇ ਉਪਲਬਧ ਹੋ ਜਾਂਦੀ ਹੈ ਮਾਰਕੀਟ ਹੈ ਸੁੰਦਰ ਸੁੰਦਰ ਮਾਰਕੀਟਾਂ ਹਰ ਚੀਜ਼ ਆਪਾਂ ਮੌਕੇ 'ਤੇ ਖ਼ਰੀਦ ਸਕਦੇ ਹਾਂ ਕਦੋਂ ਵੀ ਖਰੀਦ ਸਕਦੇ ਹਾਂ ਨੇੜਿਓ ਮਿਲ ਜਾਂਦੀ ਹੈ ਦਵਾਈ ਤੋਂ ਲੈ ਕੇ ਹਰ ਚੀਜ਼ ਚਾਹੇ ਉਹ ਬੱਚੇ ਦੀ ਹੈ ਬਜ਼ੁਰਗ ਦੀ ਹੈ ਕਿਸੇ ਦੀ ਵੀ ਅਤੇ ਆਪਾਂ ਨੂੰ ਭੀੜ ਭੜੱਕੇ ਇਲਾਕੇ ਵਾਲੇ ਸ਼ਹਿਰ ਦੇ ਵਿੱਚੋਂ ਰੌਣਕੀ ਇਲਾਕਾ ਹੁੰਦਾ ਹੈ ਹਰ ਚੀਜ਼ ਜਲਦੀ ਮਿਲ ਜਾਂਦੀ ਹੈ ਮਾਰਕੀਟ ਹੁੰਦੀ ਹੈ ਉੱਥੇ ਬਿਜ਼ਨਸ ਹੁੰਦਾ ਹੈ ਔਰ ਕਮਾਈ ਜ਼ਿਆਦਾ ਉੱਥੋਂ ਦੇ ਲੋਕਾਂ ਦੀ ਹੁੰਦੀ ਹੈ ਕਿਉਂਕਿ ਜਿੱਥੇ ਹੋਵੇਗੀ ਉੱਥੇ ਲੋਕ ਉੱਥੋਂ ਹੀ ਖਰੀਦਣਗੇ ਦੂਜੀ ਗੱਲ ਜਿੱਥੇ ਭੀੜ ਭੜੱਕਾ ਉੱਥੇ ਨੁਕਸਾਨ ਵੀ ਹੈ ਕਿਉਂਕਿ ਪੋਲਿ ਪਾਪੂਲੇਸ਼ਨ ਬਹੁਤ ਹੈ ਕਾਰਬਨ ਡਾਈਆਕਸਾਈਡ ਹੈ ਹਿਊਮਸ ਬਹੁਤ ਹੈ ਪੋਲਿਊਸ਼ਨ ਬਹੁਤ ਹੈ ਉੱਥੇ ਇਹ ਹੁੰਦਾ ਹੀ ਹੁੰਦਾ ਪੋਲਿਊਸ਼ਨ ਵੀ ਹੋਏਗਾ ਉੱਥੇ ਕਾਰਬਨ ਡਾਈਆਕਸਾਈਡ ਵੀ ਹੈ ਪੋਲਿਊਸ਼ਨ ਵੀ ਹੈ ਇਸ ਕਰਕੇ ਇਹਦਾ ਸਕਾਰਾਤਮਕ ਪਹਿਲੂ ਵੀ ਹੈ ਨਕਾਰਾਤਮ ਪਹਿਲੂ ਵੀ ਹੈ ਨਕਾਰਾਤਮ ਪਹਿਲੂ ਇਹ ਆ ਪੋਲਿਊਸ਼ਨ ਹੈ ਭੀੜ ਭੜੱਕਾ ਹੈ ਹਿਊਮਸ ਹੈ ਕੱਲ ਨੂੰ ਕੋਈ ਟੈਰਰਿਸਟ ਬੰਬ ਬਲਾਸਟ ਹੋ ਜੇ ਤਾਂ ਭੀੜ ਭਰੇ ਇਲਾਕੇ ਦੇ ਵਿੱਚ ਸੇਫਟੀ ਕਰਨੀ ਬਹੁਤ ਮੁਸ਼ਕਿਲ ਹੈ ਕੋਈ ਬਿਮਾਰੀ ਫੈਲ ਜੇ ਉੱਥੇ ਬਹੁਤ ਮੁਸ਼ਕਿਲ ਹੈ ਅਤੇ ਪੋਜ਼ੀਟਿਵ ਪਹਿਲੂ ਇਹ ਆ ਵੀ ਲੋਕ ਰੌਣਕਾਂ ਰਹਿੰਦੀਆਂ ਨੇ ਬਾਜ਼ਾਰ ਸੱਜਦੇ ਨੇ ਹਰ ਚੀਜ਼ ਈਜ਼ੀ ਅਵੇਲੇਬਲ ਹੈ